ਕਿਤਾਬਾਂ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰੱਖਦੀਆਂ ਹਨ ਕਿਉਂਕਿ ਗਿਆਨ ਦਾ ਵਾਧਾ ਕਰਨ ਦੇ ਲਈ ਸਾਨੂੰ ਕਿਤਾਬਾਂ ਦੀ ਲੋੜ ਪੈਂਦੀ ਹੈ ਪਹਿਲੀ ਕਲਾਸ ਤੋਂ ਲੈ ਕੇ ਐੱਮ ਏ ਤੱਕ ਜਾਂ ਹੋਰ ਉੱਪਰਲੀ ਪੜ੍ਹਾਈ ਕਰਨ ਦੇ ਲਈ ਸਾਨੂੰ ਕਿਤਾਬਾਂ ਦੀ ਲੋੜ ਹਮੇਸ਼ਾ ਹੀ ਪੈਂਦੀ ਰਹਿੰਦੀ ਹੈ ਪਰ ਅੱਜ ਸ ਜ਼ਮਾਨੇ ਨੇ ਜਿਹੜੀ ਕਰਵਟ ਲਈ ਹੈ ਬਦਲਾ ਲਿਆ ਹੈ ਜ਼ ਜ਼ਮਾਨੇ ਨੇ ਉਹਦੇ ਨਾਲ ਨਾਲ ਗਲੋਵਲ ਫਾਰਮਿੰਗ ਸਿਸਟਮ ਸੈੱਟ ਹੋਣ ਦੇ ਨਾਲ ਸਾਨੂੰ ਕਿਤਾਬਾਂ ਈ ਬੁੱਕ ਰਾਹੀਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਇਹਨਾਂ ਕਿਤਾਬਾਂ ਦਾ ਸਾਨੂੰ ਸਾਂਭ ਸੰਭਾਲ ਦੀ ਕੋਈ ਚਿੰਤਾ ਨਹੀਂ ਕਿਉਂਕਿ ਕਿਤੇ ਰੱਖਣ ਦੀ ਲੋੜ ਨਹੀਂ ਘਰ ਘਰ ਦੇ ਵਿੱਚ ਐਂਡਰਾਇਡ ਫੋਨ ਟੀ ਵੀ ਲੈਪਟੋਪ ਆਦਿ ਹੋਣ ਕਰਕੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਬਹੁਤੀ ਔਖੀ ਨਹੀਂ ਜਿੱਥੇ ਕਿ ਪੁਰਾਣੀਆਂ ਕਿਤਾਬਾਂ ਉਹਨਾਂ ਨੂੰ ਸਾਂਭ ਸੰਭਾਲ ਕਰਨ ਦੇ ਲਈ ਜਾਂ ਬਹੁਤਾ ਲੰਬਾ ਸਮਾਂ ਰੱਖਣ ਦੇ ਲਈ ਬਹੁਤ ਔਖਿਆਈ ਪੇਸ਼ ਆਉਂਦੀ ਸੀ ਪਰ ਇੱਥੇ ਐਸਾ ਕੁਝ ਨਹੀਂ ਹੈ